ਮੈਨੂੰ ਲੱਗਦਾ ਹੈ ਇੱਕ ਵਧੀਆ ਪੋਟਰੇਟ ਤਾਂ ਹੀ ਬਣ ਸਕਦਾ ਹੈ ਜਦੋਂ ਕਿ ਉਹ ਇਕ ਨੈਚੁਰਲ ਪੋਰਟਰੇਟ ਹੋਵੇ ਜਿਵੇਂ ਕਿ ਦੋ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਹੋਣ ਅਤੇ ਮੈਂ ਉਹਨਾਂ ਦਾ ਪੋਰਟਰੇਟ ਬਣਾ ਲਵਾਂ ਜਿਵੇਂ ਕਿ ਕੋਈ ਮਾਵਾਂ ਜਾਂ ਧੀਵਾਂ ਧੀਆਂ ਬੈਠੀਆਂ ਹੋਣ ਅਤੇ ਮੈਂ ਉਹਨਾਂ ਨੂੰ ਬਣਾ ਲਵਾਂ ਜਾਂ ਉਸ ਉਹਨਾਂ ਦਾ ਪੋਸਟਰ ਬਣਾ ਲਵਾਂ ਇਸ ਲਈ ਸਾਨੂੰ ਕੁਝ ਕਹਿਣ ਲਈ ਜਾਂ ਕੁਛ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਉਸੀਂ ਅਸੀਂ ਉਸਨੂੰ ਨੈਚੁਰਲ ਢੰਗ ਨਾਲ ਰੱਖਾਂਗੇ ਤਾਂ ਹੀ ਉਹ ਪੋਸਟਰ ਜਾਂ ਪੋਰਟਰੇਟ ਇੱਕ ਵਧੀਆ ਢੰਗ ਨਾਲ ਪੇਸ਼ ਹੋ ਸਕਦਾ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਪਾਰਕ ਵਿੱਚ ਲੋਕ ਚੱਲ ਰਹੇ ਹਨ ਅਤੇ ਯੋਗਾ ਐਕਸਰਸਾਈਜ਼ ਵਗੈਰਾ ਕਰ ਰਹੇ ਹਨ ਜੇਕਰ ਅਸੀਂ ਉਸਨੂੰ ਉਸ ਦਾ ਪੋਰਟਰੇਟ ਬਣਾਉਣਾ ਹੋਵੇ ਤਾਂ ਸਾਨੂੰ ਉਹਨਾਂ ਨੂੰ ਕੁਛ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਅਸੀਂ ਇੱਕਦਮ ਉਹਨਾਂ ਦਾ ਪੋਰਟਰੇਟ ਅਗਰ ਬਣਾ ਦੇਵਾਂਗੇ ਤਾਂ ਉਸਨੂੰ ਸੋਹਣੇ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ਇੱਥੇ ਬਹੁਤ ਸੋਹਣੇ ਸੋਹਣੇ ਪੇੜ ਪੌਦੇ ਆਦਿ ਹਨ ਜੇਕਰ ਅਸੀਂ ਉਹਨਾਂ ਦਾ ਪੋਰਟਰੇਟ ਬਣਾਈਏ ਤਾਂ ਉਹ ਇੱਕ ਬਹੁਤ ਖੂਬਸੂਰਤ ਚੀਜ਼ ਨਿਕਲ ਕੇ ਆਉਂਦੀ ਹੈ ਇਸ ਲਈ ਸਾਨੂੰ ਲੋਕਾਂ ਦੀ ਚਾਪਲੂਸੀ ਜਾਂ ਦਿਲਚਸਪੀ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਜਿੰਨਾ ਅਸੀਂ ਉਸਨੂੰ ਨੈਚੁਰਲ ਰੱਖਾਂਗੇ ਉਸਨੂੰ ਔਨ ਦ ਸਪੋਟ ਰੱਖਾਂਗੇ ਉਨਾ ਹੀ ਸਾਡੀ ਤਸਵੀਰ ਵਧੀਆ ਨਿਕਲ ਕੇ ਆਵੇਗੀ ਅੰਤ ਵਿੱਚ ਮੈਂ ਇਹ ਕਹਾਂਗੀ ਕਿ ਸਾਨੂੰ ਕਿਸੇ ਨੂੰ ਵੀ ਕੁਛ ਵੀ ਚਾਪਲੂਸੀ ਜਾਂ ਕਿਸੇ ਦੀ ਵੀ ਕੁਛ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਜਿੰਨਾ ਅਸੀਂ ਉਸਨੂੰ ਨੈਚੁਰਲ ਰੱਖਾਂਗੇ ਉਨ੍ਹਾਂ ਹੀ ਉਹ ਚੀਜ਼ ਵਧੀਆ ਬਣ ਕੇ ਆਵੇਗੀ